ਮੈਂ ਜ਼ ਲਾਈਫ ਦੇ ਵਿੱਚ ਕਾਫੀ ਸਾਰੇ ਚੈਲੇਂਜਸ ਫੇਸ ਕੀਤੇ ਨੇ ਆ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਚੈਲੇਜ ਲਗਾ ਸਕਦੇ ਹਾਂ ਕਿ ਸਟੱਡੀ ਦੇ ਵਿੱਚ ਜੋ ਵੀ ਅੱਜ ਕੱਲ੍ਹ ਕੰਪੀਟੀਸ਼ਨ ਦਾ ਬਹੁਤ ਜ਼ਿਆਦਾ ਟਾਈਮ ਹੈ ਅੱਜ ਕੱਲ੍ਹ ਇੱਕ ਦੂਜੇ ਦੇ ਨਾਲ ਬਹੁਤ ਜ਼ਿਆਦਾ ਲੋਕ ਕੰਪੀਟ ਕਰਦੇ ਜਾਂ ਬੱਚੇ ਕੰਪੀਟ ਕਰਦੇ ਆ ਸਭ ਤੋਂ ਪਹਿਲਾਂ ਚੈਲੇਂਜ ਇਹ ਸੀ ਕਿ ਜੋ ਮੇਰੇ ਨਾਲ ਦੇ ਸਟੂਡੈਂਟਸ ਹੁੰਦੇ ਸੀਗੇ ਉਹ ਸਾਰੇ ਸ਼ਹਿਰੀ ਏਰੀਏ ਨੂੰ ਬਿਲੋਂਗ ਕਰਦੇ ਸੀ ਜਿੱਥੇ ਸਟੱਡੀ ਦੀਆਂ ਫੈਸਿਲਿਟੀਜ਼ ਬਹੁਤ ਜ਼ਿਆਦਾ ਹੁੰਦੀਆਂ ਸੀਗੀਆਂ ਅਤੇ ਪਿੰਡਾਂ ਦੇ ਵਿੱਚ ਨਾ ਉਨੇ ਵਧੀਆ ਸਕੂਲ ਹੁੰਦੇ ਹਨ ਨਾ ਉਨੀਆਂ ਵਧੀਆ ਫੈਸਿਲਿਟੀਜ਼ ਜੋ ਵੀ ਆਪਾਂ ਨੂੰ ਐਜੂਕੇਸ਼ਨ ਦੇ ਲਈ ਚਾਹੀਦੀਆਂ ਹੁੰਦੀਆਂ ਹਨ ਉਹ ਨਹੀਂ ਹੁੰਦੀਆਂ ਬਟ ਜਦੋਂ ਆਪਾਂ ਪੋਸਟ ਗ੍ਰੈਜੂਏਟ ਜਾਂ ਆਪਾਂ ਗਰੈਜੂਏਟ ਲੈਵਲ 'ਤੇ ਜਾ ਕੇ ਦੇਖਦੇ ਹਾਂ ਤਾਂ ਆਪਾਂ ਨੂੰ ਕਾਫੀ ਸਾਰੇ ਉੱਥੇ ਚੈਲੇਂਜਸ ਫੇਸ ਕਰਨੇ ਪੈਂਦੇ ਨੇ ਜਦੋਂ ਆਪਾਂ ਸ਼ਹਿਰੀ ਬੱਚਿਆਂ ਦੇ ਨਾਲ ਕੰਪੀਟ ਕਰਦੇ ਹਾਂ ਜਿਹਨਾਂ ਨੂੰ ਆਲਰੇਡੀ ਇੰਨੀਆਂ ਸਾਰੀਆਂ ਕੋਚਿੰਗ ਜਾਂ ਆਪਾਂ ਟਿਊਸ਼ਨ ਦੀ ਫੈਸਿਲਿਟੀਜ਼ ਆਲਰੇਡੀ ਬਹੁਤ ਜ਼ਿਆਦਾ ਹੁੰਦੀਆਂ ਹਨ ਦੂਜੀ ਲਗਾ ਸਕਦੇ ਹਾਂ ਕਿ ਜੋ ਮੈਨੇ ਚੈਲੇਂਜ ਫੇਸ ਕੀਤਾ ਸੀ ਉਹ ਸੀ ਆਪਣੀ ਵਹੀਕਲ ਦੀ ਫੈਸਿਲਿਟੀ ਜਿਵੇਂ ਕਿ ਮੈਂ ਪੋਸਟ ਗ੍ਰੈਜੂਏਸ਼ਨ ਪੰਜਾਬੀ ਯੂਨੀਵਰਸਿਟੀ ਕੀਤੀ ਹੈ ਅਤੇ ਪਿੰਡ ਤੋਂ ਪਟਿਆਲਾ ਦੀ ਜੋ ਬੱਸ ਫੈਸਿਲਿਟੀ ਹੁੰਦੀ ਸੀ ਉਹ ਇੰਨੀ ਜ਼ਿਆਦਾ ਵਧੀਆ ਨਹੀਂ ਸੀ ਹੁੰਦੀ ਜਿਹਦੇ ਕਰਕੇ ਮੈਨੂੰ ਕਾਫੀ ਸਾਰੇ ਚੈਲੇਂਜ ਫੇਸ ਕਰਨੇ ਪੈਂਦੇ ਸੀ ਜਿੱਦਾਂ ਕਿ ਮੈਂ ਘਰੋਂ ਅਰਲੀ ਜਾਂਦੀ ਸੀ ਅਤੇ ਘਰ ਨੂੰ ਲੇਟ ਆਉਂਦੀ ਸੀਗੀ ਬਟ ਮੇਰੀ ਫੈਮਿਲੀ ਦੇ ਸਪੋਰਟ ਦੇ ਨਾਲ ਮੈਂ ਸਾਰੀਆਂ ਚੀਜ਼ਾਂ ਨੂੰ ਓਵਰਕਮ ਕੀਤਾ ਅਤੇ ਅੱਜ ਸਾਰੀਆਂ ਇਹ ਚੈਲੇਂਜਸ ਨੂੰ ਪਾਰ ਕਰਨ ਤੋਂ ਬਾਅਦ ਮੈਂ ਐਜ਼ ਅਸਿਸਟੈਂਟ ਪ੍ਰੋਫੈਸਰ ਜੋਬ ਜੁਆਇਨ ਕੀਤੀ ਹੈ ਇੱਕ ਇੰਜੀਨੀਅਰਿੰਗ ਕੋਲਜ ਦੇ ਵਿੱਚ ਸੋ ਬੇਸਿਕਲੀ ਇਹ ਚੈਲੇਂਜਸ ਸੀਗੇ ਜੋ ਮੈਨੇ ਫੇਸ ਕੀਤੇ ਨੇ ਅਤੇ ਵਿਦ ਫੈਮਲੀ ਸਪੋਰਟ ਦੇ ਨਾਲ ਮੈਂ ਇਹ ਚੀਜ਼ਾਂ ਨੂੰ ਸਾਹਮਣਾ ਕੀਤਾ ਏ ਚੈਲੇਂਜਸ ਦਾ